ਜੀ ਬਿਲਕੁਲ ਪੰਜਾਬ ਦੀ ਗੱਲ ਕਰ ਲਈਏ ਜੇਕਰ ਔਰ ਓਲ ਇੰਡੀਆ ਪੰਜਾਬ ਓਲ ਇੰਡੀਆ ਦੀ ਵੀ ਗੱਲ ਕਰ ਲਈਏ ਜਿਹੜੀ ਔਰਤਾਂ ਦੀ ਭੂਮਿਕਾ ਬਹੁਤ ਜ਼ਿਆਦਾ ਬਦਲੀ ਹੈ ਖੁੱਲ੍ਹ ਕੇ ਪੜ੍ਹਾਈ ਵੀ ਕਰ ਸਕਦੀ ਹੈ ਕੰਮ ਵੀ ਕਰ ਸਕਦੀ ਹੈ ਹੋਰ ਵੀ ਕਈ ਜਗ੍ਹਾ 'ਤੇ ਆਪਾਂ ਦੇਖਿਆ ਜਾਵੇ ਤਾਂ ਔਰਤਾਂ ਖੁੱਲ੍ਹ ਕਰ ਕੰਮ ਕਰ ਸਕਦੀਆਂ ਅਜੇ ਵੀ ਚਲੋ ਇਹ ਵੀ ਗੱਲ ਮੰਨਣ ਵਾਲੀ ਹੈ ਕੀ ਕਾਫ਼ੀ ਜ਼ਿਆਦਾ ਰੁਕਾਵਟਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜੇ ਆਪਾਂ ਇਹ ਗੱਲ ਕਰੀਏ ਕਿ ਅਗਰ ਕੋਈ ਮੈਨ ਹੈ ਉਹ ਕਰ ਜੋਬ ਕਰ ਰਿਹਾ ਹੈ ਉਹ ਨੌਕਰੀ ਕਰ ਰਿਹਾ ਹੈ ਤਾਂ ਉਹਨੂੰ ਘਰ ਦੇ ਕੰਮ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਪਰ ਲੇਕਿਨ ਅਗਰ ਇੱਕ ਲੜਕੀ ਅਗਰ ਉਹ ਕੰਮ ਕਰਦੀ ਹੈ ਤਾਂ ਉਹਨੂੰ ਘਰ ਦੇ ਕੰਮ ਦੀ ਵੀ ਨਾਲ ਜ਼ਰੂਰ ਟੈਨਸ਼ਨ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਘਰ ਨੂੰ ਚਲਾਉਣ ਬਾਰੇ ਘਰ ਦਾ ਦੇਖਣ ਬਾਰੇ ਸਾਰੀ ਚੀਜ਼ਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੁੰਦੀ ਹੈ ਉਹ ਤਾਂ ਪੱਕੀਆਂ ਹੀ ਹੈ ਅਤੇ ਉਸ ਤੋਂ ਇਲਾਵਾ ਭੂਮਿਕਾ ਜ਼ਰੂਰ ਬਦਲੀ ਹੈ ਕਾਫ਼ੀ ਜ਼ਿਆਦਾ ਬਦਲੀ ਹੈ ਪਹਿਲਾਂ ਜਿਵੇਂ ਕਿ ਪੜ੍ਹਾਈ ਨਹੀਂ ਕਰਨ ਦਿੱਤੀ ਜਾਂਦੀ ਸੀਗੀ ਪਰ ਅੱਜ ਕੱਲ੍ਹ ਹਰ ਮਾਂ ਬਾਪ ਦੀ ਵੀ ਸੋਚ ਇਹ ਹੀ ਵੀ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ ਅਤੇ ਬੱਚੇ ਆ ਪੜ੍ਹਦੇ ਵੀ ਹੈ ਔਰ ਵਧੀਆ ਸੈਟਲ ਵੀ ਹੈ ਅਤੇ ਰੁਕਾਵਟਾਂ ਵਿੱਚ ਆਪਾਂ ਗੱਲ ਕਰ ਲਈਏ ਜੇਕਰ ਕਿ ਕੋਈ ਲੋਕ ਅਜੇ ਵੀ ਐਵੇਂ ਦੇ ਹੈਗੇ ਜਿਹੜਾ ਆਪਣੇ ਘਰਾਂ ਤੋਂ ਕੁੜੀਆਂ ਨੂੰ ਦੂਰ ਨਹੀਂ ਜਾਣਾ ਚਹੁੰ ਚਾਹੁੰਦੇ ਕਿ ਹਾਂ ਵੀ ਠੀਕ ਹੈ ਸਾਡੀਆਂ ਕੁੜੀਆਂ ਬਾਹਰ ਨਾ ਪੜ੍ਹਨ ਇੱਥੇ ਪੜ੍ਹਣ ਅਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਭ ਕੁਛ ਵਧੀਆ ਹੁੰਦਾ ਹੈ ਅਗਰ ਅਸੀਂ ਆਪ ਵਧੀਆ ਤਾਂ ਸਭ ਕੁਛ ਵਧੀਆ ਹੀ ਰਹਿੰਦਾ ਹੈ ਸੋ ਜਿਹੜਾ ਵਧੀਆ ਤਰੀਕੇ ਨਾਲ ਪੜ੍ਹਨਾ ਚਾਹੀਦਾ ਹੈ ਸਾਰਿਆਂ ਨੂੰ ਵਧੀਆ ਵਧੀਆ ਨੌਕਰੀ ਜਿਹੜੀ ਕਰਨੀ ਚਾਹੀਦੀ ਹੈ